ਲੁਧਿਆਨਾ ਸ਼ਹਿਰ ਦੇ ਵਿੱਚ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਅਤੇ ਸਿੱਖਿਆ ਦੇ ਰੂਪ ਵਿੱਚ ਬਹੁਤ ਸਾਰੇ ਪ੍ਰੋਗਰਾਮ ਵਧੀਆ ਚਲ ਰਹੇ ਹਨ ਜਿਹਦੇ ਵਿੱਚ ਔਰਤਾਂ ਅਤੇ ਮਰਦਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਅੱਜ ਕੱਲ੍ਹ ਦੇ ਪਰਿਵਾਰ ਕੁੜੀਆਂ ਅਤੇ ਮੁੰਡਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਦੇ ਸਗੋਂ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਪੜ੍ਹ ਰਹੀਆਂ ਹਨ ਉਨ੍ਹਾਂ ਨੂੰ ਜ਼ਿਆਦਾ ਮੌਕੇ ਮਿਲ ਰਹੇ ਹਨ ਲਿੰਗ ਸਮਾਨਤਾ ਹੈ ਵਿਤਕਰਾ ਬਿਲਕੁਲ ਨਹੀਂ ਕੀਤਾ ਜਾਂਦਾ ਅਤੇ ਰਿਸਪੋਨਸਿਬਿਲਟੀ ਕੁੜੀਆਂ ਦੀਆਂ ਮੁੰਡਿਆਂ ਨਾਲੋਂ ਜ਼ਿਆਦਾ ਹੁੰਦੀਆਂ ਹਨ ਕੁੜੀਆਂ ਘਰ ਦਾ ਕੰਮ ਕਰਕੇ ਜਾਂਦੀਆਂ ਹਨ ਸਕੂਲ ਅਤੇ ਆ ਕੇ ਵੀ ਘਰ ਦਾ ਕੰਮ ਕਰਦੀਆਂ ਹਨ ਸਕੂਲ ਦਾ ਕੰਮ ਉਹ ਵੱਖਰਾ ਕਰਦੀਆਂ ਹਨ ਵਿਆਹ ਤੋਂ ਬਾਅਦ ਵੀ ਕੁੜੀਆਂ ਦੇ ਉੱਤੇ ਜ਼ਿੰਮੇਦਾਰੀਆਂ ਸਭ ਤੋਂ ਜ਼ਿਆਦਾ ਹੋ ਜਾਂਦੀਆਂ ਹਨ ਆਦਮੀਆਂ ਦੇ ਮੁਕਾਬਲੇ ਕੁੜੀਆਂ ਜ਼ਿਆਦਾ ਪੜ੍ਹ ਲਿਖ ਕੇ ਅੱਗੇ ਵੱਧ ਰਹੀਆਂ ਹਨ ਪਰ ਉਨ੍ਹਾਂ ਦੇ ਵਿੱਚ ਇਹ ਇਹ ਪ੍ਰੋਬਲਮ ਵੇਖਣ ਨੂੰ ਮਿਲਦੀ ਹੈ ਕਿ ਆਦਮੀ ਉਨ੍ਹਾਂ ਦੇ ਨਾਲ ਕੰਧੇ ਨਾਲ ਕੰਧਾ ਜੋੜ ਕੇ ਕੰਮ ਨਹੀਂ ਕਰਵਾ ਰਹੇ ਜਦ ਕਿ ਕੁੜੀਆਂ ਦੇ ਉੱਤੇ ਭਾਰ ਜ਼ਿਆਦਾ ਪੈ ਰਿਹਾ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਵੀ ਜ਼ਿਆਦਾ ਅਸਰ ਪੈ ਰਿਹਾ ਹੈ ਇਸ ਲਈ ਇਸ ਲਈ ਮੈਂ ਇਹ ਚਾਹੁੰਦੀ ਹਾਂ ਕਿ ਕੁੜੀਆਂ ਅਤੇ ਮੁੰਡੇ ਮਿਲ ਕੇ ਕੰਮ ਕਰਨ ਘਰ ਦਾ ਵੀ ਅਤੇ ਬਾਹਰ ਦਾ ਵੀ ਜਿਹਦੇ ਨਾਲ ਲਿੰਗ ਸਮਾਨਤਾ ਬਣੀ ਰਹੇ